ਲਾਈਟ ਪ੍ਰਦੂਸ਼ਣ ਨੇ ਸਟਾਰਗੇਜਿੰਗ ਨੂੰ ਬਹੁਤ ਅਜੀਬ ਜਿਹੇ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੋਇਆ ਹੈ ਜੇ ਬਹੁਤ ਜ਼ਿਆਦਾ ਲਾਈਟ ਪ੍ਰਦੂਸ਼ਣ ਹੋਵੇਗਾ ਤਾਂ ਤਾਰਿਆਂ ਦਾ ਨਿਰੀਖਣ ਵੀ ਚੰਗੀ ਤਰ੍ਹਾਂ ਨਹੀਂ ਕਰ ਪਾਵਾਂਗੇ ਜਿਵੇਂ ਕਿ ਧੁੰਦ ਪੈਂਦੀ ਹੈ ਤਾਂ ਕੁਝ ਵੀ ਨਹੀਂ ਦਿਖਾਈ ਦਿੰਦਾ ਇਸੇ ਤਰ੍ਹਾਂ ਜਦੋਂ ਲਾਈਟ ਪੈਂਦੀ ਹੈ ਤਾਂ ਸਾਨੂੰ ਅਸਮਾਨ ਦੇ ਵਿੱਚ ਤਾਰੇ ਵੀ ਸਾਫ਼ ਨਹੀਂ ਦਿਖਾਈ ਦਿੰਦੇ ਜਦ ਅਸੀਂ ਧੁੰਦ ਵਿੱਚ ਲਾਈਟ ਪਾਸ ਕਰ ਦਿੰਦੇ ਹਾਂ ਤਾਂ ਥਾਂ ਸਾਨੂੰ ਅੱਗੇ ਵਾਲੀ ਚੀਜ਼ ਥੋੜ੍ਹੀ ਦਿਖਾਈ ਦੇਣ ਲੱਗ ਜਾਂਦੀ ਹੈ ਇਸੇ ਤਰ੍ਹਾਂ ਜੇ ਵਾਤਾਵਰਨ ਸਾਫ਼ ਹੋਏਗਾ ਤਾਂ ਸਾਨੂੰ ਸ ਤਾਰੇ ਵੀ ਦਿਖਣ ਲੱਗ ਜਾਂਦੇ ਹਨ ਲਾਈਟ ਨੇ ਸਾਡੇ ਇਕੋ ਸਿਸਟਮ 'ਤੇ ਵੀ ਕਾਫੀ ਹਿਲਾ ਦਿੱਤਾ ਹੈ ਇਸ ਨਾਲ ਸਾਡੀ ਸਿਹਤ 'ਤੇ ਵੀ ਅਸਰ ਹੁੰਦਾ ਹੈ ਐਸਟੋਨੋਮੀਕਲ ਰਿਸਰਚ 'ਤੇ ਵੀ ਅਸਰ ਹੁੰਦਾ ਹੈ ਜਿੱਦਾਂ ਰਿਸਰਚ ਵਿਗਿਆਨੀ ਮੌਸਮ ਨੂੰ ਦੱਸਦੇ ਨੇ ਕਿ ਕੱਲ੍ਹ ਬਾਰਿਸ਼ ਹੋਣੀ ਆ ਜਾਂ ਧੁੱਪ ਨਿਕਲਣੀ ਆ ਇਸ ਤਰ੍ਹਾਂ ਵੀ ਇਸ 'ਤੇ ਵੀ ਫੈਕਟ ਪੈਂਦਾ ਲਾਈਟ ਪ੍ਰਦੂਸ਼ਣ ਦਾ ਅਸੀਂ ਤਾਰਿਆਂ ਦਾ ਨਿਰੀਖਣ ਇੱਕ ਉੱਚੀ ਜਗ੍ਹਾ 'ਤੇ ਜਾਂ ਕਿਸੇ ਪਹਾੜ 'ਤੇ ਚੜ੍ਹ ਕੇ ਜਾਂ ਵਾਤਾਵਰਨ ਜਿੱਥੇ ਸਾਫ਼ ਹੋਵੇ ਜਿਵੇਂ ਕਿ ਲਦਾਖ ਉੱਥੇ ਅਸੀਂ ਤਾਰਿਆਂ ਦਾ ਨਿਰੀਖਣ ਆ ਜਿਹੜਾ ਬੜੇ ਹੀ ਸਚੁੱਜੇ ਢੰਗ ਨਾਲ ਕਰ ਸਕਦੇ ਹਾਂ ਧੰਨਵਾਦ